ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੇ ਅੰਦਰ ਪੰਜਾਬੀ ਸ਼ਬਦ ਅਤੇ ਵਾਕਿਆਂਸ਼ ਇਹ ਬਹੁਤ ਹੀ ਅੱਛੇ ਲੱਗਦੇ ਹਨ ਅਤੇ ਬਹੁਤ ਹੀ ਸੁਣਨ ਵਿੱਚ ਚੰਗੇ ਲੱਗਦੇ ਹਨ ਕਿਉਂਕਿ ਇਹ ਸਾਡੀ ਆਪਣੀ ਮਾਤਰ ਭਾਸ਼ਾ ਯਾਨੀ ਕਿ ਮਾਂ ਬੋਲੀ ਹੁੰਦੀ ਹੈ ਸ਼ਬਦ ਉੱਤੇ ਹੁਣ ਆਪਾਂ ਤੁਹਾਨੂੰ ਕੀ ਦੱਸੀਏ ਸ਼ਬਦ ਆਪਣੇ ਆਪ 'ਚ ਹੀ ਇੱਕ ਬਹੁਤ ਹੀ ਸੁੰਦਰ ਮਤਲਬ ਹੁੰਦਾ ਹੈ ਜਿਹੜਾ ਕਿ ਖੁਦ ਪੂਰਾ ਤਾਂ ਨਹੀਂ ਹੁੰਦਾ ਲੇਕਿਨ ਉਹਦੇ ਨਾਲ ਜੋੜੇ ਗਏ ਸ਼ਬਦਾਂ ਦੇ ਨਾਲ ਇੱਕ ਵਾਕਯ ਤਿਆਰ ਕੀਤਾ ਜਾਂਦਾ ਹੈ ਜਿਹਨੂੰ ਵਾਕਾਂਸ਼ ਕਹਿੰਦੇ ਹਨ ਹੁਣ ਸ਼ਬਦ ਜਿਹੜੇ ਹਨ ਉਹਨਾਂ ਦੇ ਵਿੱਚ ਮੁਕੰਮਲ ਰੂਪ 'ਤੇ ਉਹਨਾਂ ਦੇ ਨਾਲ ਲਗਾਂ ਮਾਤਰਾ ਲਾ ਕੇ ਫਿਰ ਇੱਕ ਸ਼ਬਦ ਤਿਆਰ ਹੁੰਦਾ ਹੈ ਉਹ ਸ਼ਬਦ ਜਿਹੜਾ ਹੈ ਦੋ ਤਰ੍ਹਾਂ ਦੇ ਹੁੰਦੇ ਇੱਕ ਸਾਰਥਕ ਅਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਜਿਹੜੇ ਹਨ ਉਹ ਆਪਣੇ ਆਪ ਦੇ ਵਿੱਚ ਸੁਤੰਤਰ ਹੁੰਦੇ ਹਨ ਜਿਸ ਤਰ੍ਹਾਂ ਕਿ ਕੁਰਸੀ ਮੇਜ ਰੋਟੀ ਇਹ ਆਪਣੇ ਆਪ 'ਚ ਹੀ ਇਹਨਾਂ ਦੀ ਵਿਆਖਿਆ ਹੋ ਜਾਂਦੀ ਹੈ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਇਹਨਾਂ ਵਿੱਚ ਪਾਣੀ ਦੁੱਧ ਵੀ ਆਉਂਦਾ ਹੈ ਅਤੇ ਜਿਹੜੇ ਨਿਰਾਰਥਕ ਸ਼ਬਦ ਨੇ ਇਹ ਸਾਰਥਕ ਸ਼ਬਦਾਂ ਦਾ ਨਾਲ ਜੋੜੇ ਗਏ ਸ਼ਬਦ ਹਨ ਉਹਨਾਂ ਦਾ ਆਪਸ 'ਚ ਕੋਈ ਮੇਨ ਮਕਸਦ ਜਾਂ ਮੇਨ ਸਪੱਸ਼ਟ ਅਰਥ ਨਹੀਂ ਹੁੰਦਾ ਜਿਸ ਤਰ੍ਹਾਂ ਰੋਟੀ ਸ ਰੋਟੀ ਰੂਟੀ ਹੁਣ ਰੋਟੀ ਦਾ ਤਾਂ ਸ਼ਬਦ ਅਰਥ ਹੈ ਲੇਕਿਨ ਰੂਟੀ ਦਾ ਨਹੀਂ ਇਸੇ ਤਰ੍ਹਾਂ ਪਾਣੀ ਧਾਣੀ ਚਾਹ ਚੁਹ ਦੁੱਧ ਸ਼ੁੱਧ ਇਹ ਪਿੱਛੇ ਜਿਹੜੇ ਸ਼ਬਦ ਲੱਗਦੇ ਹਨ ਇਹ ਇਸ ਤਰ੍ਹਾਂ ਦੇ ਹਨ ਅਤੇ ਪੰਜਾਬੀ ਬੋਲੀ ਬਹੁਤ ਅੱਛੀ ਹੈ ਅਤੇ ਸੁੰਦਰ ਹੈ ਅਤੇ ਇਸਦੇ ਬੁਲਾਰਾ ਜਿਹੜੇ ਹੋਣ 'ਤੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਭਾਸ਼ਾ ਦੇ ਵਿੱਚ ਇਤਨੀ ਮਿਠਾਸ ਹੈ ਕਿ ਕੋਈ ਵੀ ਇਸ ਨੂੰ ਅਪਣਾ ਲੈਂਦਾ ਹੈ ਅਤੇ ਜਦੋਂ ਤੁਸੀਂ ਦੂਸਰੇ ਦੇ ਨਾਲ ਇਹ ਗੱਲਬਾਤ ਕਰਦੇ ਹੋ ਉਹ ਅਤੇ ਉਹਨੂੰ ਇਹ ਭਾਸ਼ਾ ਬਹੁਤ ਹੀ ਸੁੰਦਰ ਲੱਗਦੀ ਹੈ ਬਸ ਇਹ ਹੀ ਹੈ ਇਸੇ ਕਰਕੇ ਇਹ ਸਾਨੂੰ ਇਹ ਇਹਦੇ ਉੱਤੇ ਮੈਨੂੰ ਬਹੁਤ ਮਾਨ ਮਹਿਸੂਸ ਹੁੰਦਾ ਹੈ